ਅਕਸਰ ਮੈਂ ਓਨਲਾਈਨ ਸ਼ੋਪਿੰਗ ਕਰਦਾ ਰਹਿੰਦਾ ਜਿਵੇਂ ਕਿ ਘੜੀਆਂ ਸ਼ੂਜ਼ ਕੱਪੜੇ ਹੈਡਸ ਮੈਨੂੰ ਵੈਸੇ ਖਰੀਦਾਰੀ ਦਾ ਬਹੁਤ ਜ਼ਿਆਦਾ ਸ਼ੌਕ ਹੈ ਤਾਂ ਹਾਲ ਹੀ ਦੇ ਵਿੱਚ ਮੈਂ ਇੱਕ ਓਨਲਾਈਨ ਕੱਪੜਿਆਂ ਦੀ ਰੀਸਟੋਰ ਦੇ ਵਿੱਚੋਂ ਇੱਕ ਟੀ ਸ਼ਰਟ ਖਰੀਦੀ ਜਿਸ ਦਾ ਰੰਗ ਅਤੇ ਜਿਹਦਾ ਫੈਬਰਿਕ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆਇਆ ਜਦੋਂ ਮੇਰੇ ਕੋਲ ਪਹੁੰਚੀ ਤਾਂ ਸੋਚਿਆ ਕਿਉਂ ਨਾ ਬਾਕੀ ਲੋਕਾਂ ਵਾਸਤੇ ਵੀ ਉਸ ਕੰਪਨੀ ਦੀ ਉਸ ਪ੍ਰੋਡਕਟ 'ਤੇ ਫੀਡਬੈਕ ਛੱਡਿਆ ਜਾਵੇ ਤਾਂ ਜੋ ਲੋਕਾਂ ਨੂੰ ਉਸ ਨੂੰ ਚੂਸ ਕਰਨ ਦੇ ਵਿੱਚ ਸਹਾਇਤਾ ਮਿਲੇ ਉਹਨਾਂ ਨੂੰ ਕੋਈ ਜ਼ਿਆਦਾ ਪੁੱਛ ਪੁੱਛ ਪੜਤਾਲ ਕਰਨ ਦੀ ਜ਼ਰੂਰਤ ਨਾ ਪਵੇ ਤਾਂ ਜਦੋਂ ਮੈਂ ਖਰੀਦੀ ਤਾਂ ਮੈਂ ਆਪਣਾ ਅਨੁਭਵ ਤੁਹਾਨੂੰ ਦੱਸ ਰਿਹਾ ਮੈਂ ਉਸ 'ਤੇ ਲਿਖ ਰਿਹਾ ਹਾਂ ਕਿ ਜਿਹੜੀ ਇਹ ਸ਼ਰਟ ਆਈ ਮੈਨੂੰ ਪਹਿਲੀ ਨਜ਼ਰ 'ਚ ਪਸੰਦ ਆਈ ਮੈਂ ਵੀ ਇਸ ਦੀ ਜਾਂਚ ਪੜਤਾਲ ਕੀਤੀ ਸੀ ਥੋੜ੍ਹੀ ਜਾਂਚ ਪੜਤਾਲ ਕਰਨ ਤੋਂ ਬਾਅਦ ਮੈਂ ਇਸਨੂੰ ਓਰਡਰ ਕੀਤਾ ਓਰਡਰ ਕਰਨ ਤੋਂ ਬਾਅਦ ਜਦੋਂ ਮੇਰੇ ਕੋਲ ਇਹ ਪਹੁੰਚੀ ਤਾਂ ਇਸ ਦਾ ਜਿਹੜਾ ਫੈਬਰਿਕ ਆ ਉਹ ਬਹੁਤ ਹੀ ਜ਼ਿਆਦਾ ਸਮੂਦ ਸੀ ਜਿਹੋ ਜਿਹਾ ਮੈਨੂੰ ਚਾਹੀਦਾ ਸੀ ਕਿਉਂਕਿ ਮੈਂ ਜਿਹੜਾ ਹਾਰਡ ਕੱਪੜਾ ਉਹ ਨਹੀਂ ਪਾ ਸਕਦਾ ਮੇਰੀ ਸਕਿਨ ਨੂੰ ਐਲਰਜੀ ਹੋ ਜਾਂਦੀ ਹੈ ਹਾਰਡ ਕੱਪੜੇ ਕੱਪੜੇ ਤੋਂ ਇਹਦਾ ਜਿਹੜਾ ਕੱਪੜਾ ਸੀਗਾ ਉਹ ਬਹੁਤ ਹੀ ਜ਼ਿਆਦਾ ਸੋਫਟ ਸੀਗਾ ਇਸ ਦੇ ਕਾਲਰਜ਼ ਦਾ ਡਿਜ਼ਾਇਨ ਬਹੁਤ ਹੀ ਜ਼ਿਆਦਾ ਖੂਬਸੂਰਤ ਸੀ ਇਸਦੀ ਕਲਰ ਕੰਬੀਨੇਸ਼ਨ ਬਾਕਮਾਲ ਅਤੇ ਇਸਦਾ ਪ੍ਰਾਈਸ ਉਸ ਤੋਂ ਵੀ ਜ਼ਿਆਦਾ ਵਧੀਆ ਕਿਉਂਕਿ ਇਹ ਜ਼ਿਆਦਾ ਕੋਸਟਲੀ ਨਹੀਂ ਸੀ ਹਰ ਇੱਕ ਇਨਸਾਨ ਮੋਸਟਲੀ ਇਨਸਾਨ ਇਸ ਨੂੰ ਜਿਹੜਾ ਵੀ ਖਰੀਦ ਸਕਦੇ ਨੇ ਇਹਦੀ ਜਿਹੜੀ ਕੀਮਤ ਸੀ ਉਹ ਸਿਰਫ ਅੱਠ ਸੌ ਰੁਪਏ ਸੀ ਤਾਂ ਅੱਠ ਸੌ ਰੁਪਏ ਵਿੱਚ ਇੰਨਾ ਸੋਹਣਾ ਕੱਪੜਾ ਮਿਲਣਾ ਇੰਨਾ ਸੋਹਣਾ ਫੈਬਰਿਕ ਮਿਲਣਾ ਉਹ ਇੰਨਾ ਸੋਹਣਾ ਡਿਜ਼ਾਈਨ ਅਤੇ ਕਲਰ ਕੰਬੀਨੇਸ਼ਨ ਮਿਲਣਾ ਉੱਪਰੋਂ ਜਿਹੜੀ ਇਸਦੀ ਕੋਸਟ ਨਹੀਂ ਕਹਿ ਸਕਦੀ ਵੀ ਇਸਦੀ ਪਹੁੰਚ ਸੀਗੀ ਹੋਮ ਡਿਲੀਵਰੀ ਦੀ ਜਿਹੜੀ ਕੋਸਚ ਕੋਈ ਐਡ ਨਹੀਂ ਕੀਤੀ ਗਈ ਸੀ ਐਕਸਟਰਾ ਉਸੇ ਅੱਠ ਸੌ ਰੁਪਏ ਵਿੱਚ ਮੈਨੂੰ ਇਹ ਪਹੁੰਚ ਕੀਤੀ ਗਈ ਅਤੇ ਜੇ ਤੁਹਾਨੂੰ ਇਹ ਚੀਜ਼ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਬੇ ਝਿਜਕ ਤੁਸੀਂ ਉਸਨੂੰ ਰਿਟਰਨ ਵੀ ਕਰ ਸਕਦੇ ਹੋ